ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਖਾਣ ਪੀਣ ਦੇ ਤਰੀਕੇ ਵੱਖਰੇ ਹੁੰਦੇ ਹਨ ਜਿਵੇਂ ਕਿ ਪੇਂਡੂ ਖੇਤਰਾਂ ਵਿੱਚ ਲੋਕ ਸਾਦਾ ਅਤੇ ਪਿਓਰ ਖਾਣਾ ਖਾਨਾ ਠੀਕ ਸਮਝਦੇ ਹਨ ਉਸ ਦੇ ਉਲਟ ਸ਼ਹਿਰਾਂ ਵਿੱਚ ਲੋਕ ਜਲਦੀ ਬਣਨ ਵਾਲਾ ਜਾਂ ਜਿਸ ਨੂੰ ਜੰਕ ਫੂਡ ਕਹਿੰਦੇ ਹਨ ਉਹ ਵੀ ਖਾ ਕੇ ਰਾਜੀ ਹੁੰਦੇ ਹਨ ਪਰ ਪੇਂਡੂ ਖੇਤਰਾਂ ਵਿੱਚ ਸਾਦਾ ਖਾਣਾ ਹੀ ਖਾਦਾ ਜਾਂਦਾ ਹੈ